ਸਾਡੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ ਰੱਖਣ ਲਈ ਅਸੀਂ ਕੁਛ ਕੁ ਉਪਾਏ ਕਰਦੇ ਹਨ ਹਾਂ ਜਿਵੇਂ ਕਿ ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੇ ਜਿਹੜੇ ਨੇੜੇ ਤੇੜੇ ਦੇ ਇਲਾਕੇ ਹੈ ਉਹਨਾਂ ਦੇ ਜਿੱਥੋਂ ਤੱਕ ਸਾਡਾ ਹੋ ਸਕਦਾ ਅਸੀਂ ਕੂੜੇਦਾਨ ਦਾ ਪ੍ਰਬੰਧ ਕੀਤਾ ਹੋਇਆ ਕੂੜੇਦਾਨ ਅਸੀਂ ਜਗ੍ਹਾ ਜਗ੍ਹਾ ਰ ਰੱਖੇ ਹੋਏ ਹੈ ਤਾਂ ਕਿ ਆਉਂਦੇ ਜਾਂਦੇ ਲੋਕ ਜੋ ਵੀ ਉਹਨਾਂ ਦਾ ਜੋ ਵੀ ਉਹਨਾਂ ਨੇ ਕੁਛ ਵੀ ਫੇਕਨਾ ਹੈ ਕੁਛ ਵੀ ਸੁੱਟਣਾ ਹੈ ਤਾਂ ਉਹ ਉਸ ਕੂੜੇਦਾਨਾਂ ਦੇ ਵਿੱਚ ਸੁੱਟ ਦੇਣ ਤਾਂ ਕਿ ਸਾਡਾ ਆਲਾ ਦੁਆਲਾ ਸਾਫ ਰਵੇ ਦੂਸਰੀ ਗੱਲ ਅਸੀਂ ਆਪਦੇ ਘਰ ਦੇ ਆਲੇ ਦੁਆਲੇ ਦੇ ਜਿਹੜੇ ਨੇੜੇ ਤੇੜੇ ਇਲਾਕੇ ਹੈ ਉਹਨਾਂ ਦੇ ਵਿੱਚ ਅਸੀਂ ਦਰਖਤ ਬਹੁਤ ਲਗਾਏ ਹਨ ਦਰਖਤਾਂ ਦੇ ਕਾ ਲੱਗ ਲੱਗਣ ਨਾਲ ਕਾਫੀ ਹੱਦ ਤੱਕ ਸਾਨੂੰ ਸ਼ੁੱਧ ਹਵਾ ਮਿਲਦੀ ਹੈ ਜਿਸ ਨਾਲ ਅਸੀਂ ਇੱਕ ਤਾਂ ਸ਼ੁੱਧਤਾ ਮਿਲਦੀ ਹੈ ਸਾਨੂੰ ਸਾਡੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਅਤੇ ਨਾਲੇ ਦੂਸਰੀ ਗੱਲ ਹੈ ਕਿ ਲੋਕੀ ਸਫਾਈ ਵੀ ਰੱਖਦੇ ਹਨ ਦੇਖਦੇ ਹਨ ਕਿ ਸਾਡੇ ਦਰਖਤਾਂ ਦੀ ਕਿੰਨੀ ਜ਼ਰੂਰਤ ਹੈ ਸਾਨੂੰ ਇਸ ਦੇ ਨਾਲ ਨਾਲ ਲੋਕੀ ਵੀ ਸਫਾਈ ਦਾ ਧਿਆਨ ਰੱਖਦੇ ਹਨ ਤੀਸਰੀ ਗੱਲ ਅਸੀਂ ਕੁਝ ਕੁ ਸ ਸਫਾਈ ਸੇਵਕਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਜਿਹੜੇ ਕਿ ਰੋਜ਼ ਉੱਥੋਂ ਝਾੜੂ ਨਿਕਾਲਦੇ ਹਨ ਨੇੜੇ ਤੇੜੇ ਦੇ ਇਲਾਕਿਆਂ ਦੇ ਕੂੜੇਦਾਨਾਂ ਨੂੰ ਸਾਫ ਕਰਦੇ ਹਨ ਕੂੜੇਦਾਨ ਖਾਲੀ ਕਰਕੇ ਫਿਰ ਉੱਥੇ ਰੱਖਦੇ ਹਨ ਅਤੇ ਬਾਕੀ ਜੋ ਵੀ ਆਲੇ ਦੁਆਲੇ ਜਿਹੜੀ ਵੀ ਗੰਦਗੀ ਪਈ ਹੁੰਦੀ ਹੈ ਉਹਨਾਂ ਨੂੰ ਉਹ ਸਮੇਟਦੇ ਹਨ ਝਾੜੂ ਨਾਲ ਅਤੇ ਫਿਰ ਉਸ ਨੂੰ ਆਪਣੇ ਕੂੜੇਦਾਨਾਂ ਦੇ ਵਿੱਚ ਵੱਡੇ ਕੂੜੇਦਾਨਾਂ ਦੇ ਵਿੱਚ ਪਾ ਕੇ ਉੱਥੇ ਲੈ ਜਾਂਦੇ ਹਨ ਜਿਸ ਜਿਸਦੇ ਨਾਲ ਉਹ ਰੀਸਾਈਕਲ ਵੀ ਕਰਦੇ ਹਨ ਇਸ ਤਰ੍ਹਾਂ ਅਸੀਂ ਆਪਦੇ ਆਲੇ ਦੁਆਲਿਆਂ ਦੇ ਇਲਾਕਿਆਂ ਨੂੰ ਬਹੁਤ ਸਾਫ ਸੁਥਰਾ ਰੱਖਣ ਦੀ ਉਪਾਅ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ